ਮੇਰੇ ਖਿਆਲ ਵਿੱਚ ਗੇਮਿੰਗ ਦਾ ਭਵਿੱਖ ਹੁਣ ਬਹੁਤ ਵਧੀਆ ਹੈ ਪਹਿਲਾਂ ਲੋਕ ਕਹਿੰਦੇ ਸੀ ਕਿ ਗੇਮਿੰਗ ਵਿੱਚ ਬਿਲਕੁਲ ਪੈਸਾ ਨਹੀਂ ਹੈ ਇਹ ਕੋਈ ਕਰੀਅਰ ਆਪਸ਼ਨ ਨਹੀਂ ਹੈ ਬਟ ਹੁਣ ਸਾਰੇ ਕਹਿੰਦੇ ਨੇ ਕਿ ਜੇ ਗੇਮਿੰਗ ਕਰਦਾ ਹੈ ਤਾਂ ਹੁਣ ਪੈਸਾ ਕਮਾਉਂਦਾ ਹੋਇਆ ਕਿਉਂਕਿ ਅੱਜ ਕੱਲ੍ਹ ਮੈਕਸ ਤੋਂ ਮੈਕਸ ਬੰਦਾ ਕਰੋੜ ਤੱਕ ਕਮਾ ਸਕਦਾ ਹੈ ਹੁਣ ਤਾਂ ਕੋਈ ਲਿਮਿਟ ਨਹੀਂ ਹੈ ਅਤੇ ਗੇਮਿੰਗ ਖੇਡ ਕੇ ਬੰਦਾ ਕਿਹੋ ਜਿਹੇ ਪੈਸਾ ਕਮਾ ਸਕਦਾ ਬਸ ਬੰਦੇ ਕੋਲ ਟੈਲੈਂਟ ਹੋਣਾ ਚਾਹੀਦਾ ਪਹਿਲਾਂ ਲੋਕ ਗੇਮਿੰਗ ਨੂੰ ਬਹੁਤ ਗੰਦਾ ਸਪੋਰਟ ਮੰਨਦੇ ਸੀ ਅਤੇ ਗੇਮਿੰਗ ਨੂੰ ਕਾਫੀ ਨੈਗੇਟਿਵ ਵਿੱਚ ਲੈਂਦੇ ਸੀਗੇ ਕਿ ਅੱਖਾਂ ਖ਼ਰਾਬ ਹੋ ਜਾਣੀਆਂ ਤੂੰ ਵਿਗੜ ਜਾਣਾ ਪੜ੍ਹਾਈ ਕਰਿਆ ਕਰ ਪੜ੍ਹਾਈ ਕਰਿਆ ਕਰ ਪਰ ਹੁਣ ਮੈਂ ਮੰਨਦਾ ਕਿ ਪੜ੍ਹਾਈ ਕਰਕੇ ਉੱਨਾ ਪੈਸਾ ਨਹੀਂ ਕਮਾਇਆ ਜਾ ਸਕਦਾ ਜਿੰਨਾ ਇੱਕ ਗੇਮਰ ਕਮਾ ਸਕਦਾ ਹੈ ਅਤੇ ਗੇਮਿੰਗ ਦਾ ਭਵਿੱਖ ਹੁਣ ਬਹੁਤ ਵਧੀਆ ਹੋਇਆ ਜਾਂਦਾ ਅਤੇ ਅੱਜ ਕੱਲ੍ਹ ਕਈ ਛੋਟੇ ਬੱਚੇ ਵੀ ਇਤੋ ਇਹ 'ਚ ਪਾਟ ਲੈਂਦੇ ਹਨ ਅਤੇ ਉਹ ਵੀ ਕਾਫੀ ਪੈਸਾ ਕਮਾ ਰਹੇ ਹਨ ਅਤੇ ਆਪਣੇ ਟੈਲੈਂਟ ਦਾ ਸ਼ੋ ਸਾਰੀ ਦੁਨੀਆ ਨੂੰ ਦੁਨੀਆ ਦੇ ਸਾਹਮਣੇ ਵਿਖਾ ਰਹੇ ਹਨ ਗੇਮਰਜ ਵੀ ਅੱਜ ਕੱਲ੍ਹ ਕਾਫੀ ਪੋਪੂਲਰ ਹੁੰਦੇ ਹਨ ਅਤੇ ਜਿਵੇਂ ਸਾਡੇ ਇੰਡੀਆ ਦੇ ਕਾਫੀ ਫੇਮਸ ਗੇਮਰਜ ਨੇ ਜਿਵੇਂ ਮੋਰਟਲ ਸਕਾਊਟ ਅਤੇ ਬਾ ਬਾਹਰਲੇ ਦੇਸ਼ਾਂ 'ਚ ਸਭ ਤੋਂ ਪੋਪੂਲਰ ਬੰਦਾ ਹੈ ਰਨਿੰਜਾ ਅਤੇ ਕਾਫੀ ਪਾਪੂਲਰ ਟੀਮਸ ਨੇ ਕਿ ਗੇਮਿੰਗ ਗੇਮਿੰਗ ਅੱਜ ਕੱਲ੍ਹ ਕਾਫੀ ਜ਼ਿਆਦਾ ਲੋਕਾਂ ਤੱਕ ਪਹੁੰਚ ਗਈ ਆ ਅਤੇ ਹੁਣ ਫੈਨਸ ਵੀ ਕਾਫੀ ਹੋ ਗਏ ਨੇ ਇਸ ਗੇਮ ਦੇ ਜਿੱਥੇ ਵੀ ਇਹ ਗੇਮ ਹੁੰਦੀ ਹੈ ਇਹਦੇ ਫੈਨਸ ਕਾਫੀ ਕਾਫੀ ਮਾਤਰਾ ਵਿੱਚ ਪੁੱਜਦੇ ਨੇ ਅਤੇ ਗੇਮਰਜ ਨੂੰ ਕਾਫੀ ਪਿਆਰ ਮਿਲਦਾ ਹੈ ਅਤੇ ਇਹ ਗੇਮ ਨੂੰ ਕਾਫੀ ਪਿਆਰ ਦਿਆ ਦਿਆ ਜਾਂਦਾ ਹੈ ਅਤੇ ਹੁਣ ਗੇਮਿੰਗ ਵੀ ਸਾਡੇ ਹੁਣ ਇੱਕ ਸਪੋਰਟਸ ਦਾ ਪਾਰਟ ਬਣ ਗਈ ਹੈ ਅਤੇ ਸਰਕਾਰ ਵੀ ਕਾਫੀ ਇਨੀਸ਼ੀਏਟਿਜ਼ ਲੈ ਰਹੀ ਹੈ ਕਿ ਕਾਫੀ ਬੱਚੇ ਨੂੰ ਗੇਮਿੰਗ ਬਾਰੇ ਦੱਸਿਆ ਜਾਵੇ ਇੰਟਰੋਡਿਊਸ ਕੀਤਾ ਜਾਵੇ ਅਤੇ ਗੇਮਿੰਗ ਨੂੰ ਇੱਕ ਇਹੋ ਜਿਹੀ ਚੀਜ਼ ਬਣਾਈ ਜਾਵੇ ਜਿੱਥੇ ਲੋਕ ਡਰੇ ਨਾ ਅਤੇ ਉਹਨਾਂ ਨੂੰ ਖੇਡਣ ਨਾਲ ਐਕਸਾਈਟਮੈਂਟ ਹੋਵੇ ਅਤੇ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਡਾ ਗੇਮ ਦੇ ਵਿੱਚ ਟੈਲੈਂਟ ਹੈ ਤਾਂ ਉਹ ਟੈਲੈਂਟ ਨੂੰ ਕਦੇ ਵੇਸਟ ਨਾ ਕਰੋ ਗੇਮ ਖੇਡੋ ਇੱਕ ਲਿਮਿਟ 'ਚ ਖੇਡੋ ਅਤੇ ਗੇਮਿੰਗ ਕਰਕੇ ਆਪਣਾ ਨਾਮ ਰੌਸ਼ਨ ਕਰੋ ਕਿਉਂਕਿ ਅੱਜ ਕੱਲ੍ਹ ਕਾਫੀ ਬੰਦੇ ਗੇਮ ਖੇਡ ਕੇ ਪੋਪੂਲਰ ਹੋ ਰਹੇ ਹਨ ਅਤੇ ਕਾਫੀ ਪੋਪੂਲਰ ਹੋ ਰਹੇ ਹਨ ਤੁਸੀਂ ਜੇ ਤੁਹਾਡੇ ਕੋਲ ਵੀ ਟੈਲੈਂਟ ਹੈਗਾ ਤੁਸੀਂ ਵੀ ਪਾਪੂਲਰ ਹੋ ਸਕਦੇ ਹੋ ਗੇਮ ਵਿੱਚ ਮਿਹਨਤ ਕਰੋ ਕਿਉਂਕਿ ਕੋਈ ਵੀ ਚੀਜ਼ ਬਿਨਾਂ ਮਿਹਨਤ ਦੇ ਨਹੀਂ ਪ੍ਰਾਪਤ ਕੀਤੀ ਜਾਂਦੀ ਮਿਹਨਤ ਕਰੋ ਜੇ ਤੁਸੀਂ ਮਿਹਨਤ ਕਰੋਗੇ ਤਾਂ ਪੱਕਾ ਕੁਛ ਨਾ ਕੁਛ ਤੁਸੀਂ ਬਣੋਗੇ ਅਤੇ ਗੇਮਿੰਗ ਨੂੰ ਵੀ ਹੁਣ ਕਾਫੀ ਚਰਚਾ ਵਿੱਚ ਆ ਗਈ ਹੈ ਅਤੇ ਗੇਮਰਜ਼ ਵੀ ਕਾਫੀ ਚਰਚਾ ਵਿੱਚ ਨੇ ਅਤੇ ਮੈਂ ਇਹ ਕਹਿੰਦਾ ਗੇਮਿੰਗ ਨੂੰ ਕਦੇ ਵੀ ਲਾਈਟਲੀ ਨਹੀਂ ਲਿਆ ਜਾਏ ਗੇਮਿੰਗ ਸਾਨੂੰ ਬਹੁਤ ਨਾਮ ਕਮਾ ਕੇ ਦੇ ਸਕਦੀ ਹੈ ਬਹੁਤ ਪੈਸਾ ਕਮਾ ਦੇ ਸਕਦੀ ਹੈ ਤਾਂ ਸਾਨੂੰ ਕੁਛ ਵੀ ਪ੍ਰਾਪਤ ਕਰਵਾ ਸਕਦੀ ਹੈ